ਪੇਂਡੂ ਖੇਤਰ ਦੇ ਕਿਸਾਨਾਂ ਨੂੰ ਜ਼ਮੀਨ ਦੀ ਮਿਆਦ ਅਤੇ ਜਾਇਦਾਦ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਬਹੁਤ ਚੁਨੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸਾਨ ਜਦੋਂ ਜ਼ਮੀਨ ਖਰੀਦਦਾ ਹੈ ਤਾਂ ਉਸ ਦੀ ਰਜਿਸਟਰੀ ਕਰਵਾਉਣ ਲਈ ਸਰਕਾਰੀ ਦਫਤਰਾਂ ਦੇ ਧੱਕੇ ਖਾਣੇ ਪੈਂਦੇ ਹਨ ਕਦੇ ਪਟਵਾਰੀ ਨਹੀਂ ਮਿਲਦਾ ਕਦੇ ਤਹਿਸੀਲਦਾਰ ਨਹੀਂ ਮਿਲਦਾ ਕਦੇ ਕਾਨੂਗੋ ਨਹੀਂ ਮਿਲਦਾ ਅਤੇ ਕਦੇ ਕੋਈ ਹੋਰ ਅਫਸਰ ਨਹੀਂ ਮਿਲਦਾ ਜੇ ਇੰਤਕਾਲ ਕਰਵਾਉਣੀ ਹੋਵੇ ਜਾਂ ਜ਼ਮੀਨ ਦੀ ਹੱਦਬੰਦੀ ਕਰਵਾਉਣੀ ਹੋਵੇ ਤਾਂ ਵੀ ਬਹੁਤ ਮੁਸ਼ਕਿਲਾਂ ਆਉਂਦੀਆਂ ਹਨ ਜਦੋਂ ਸਾਨੂੰ ਜ਼ਮੀਨ ਨਾਲ ਸੰਬੰਧਿਤ ਮੁੱਦੇ ਆਉਂਦੇ ਹਨ ਤਾਂ ਅਸੀਂ ਪਟਵਾਰੀ ਕੋਲ ਕਾਨੂਗੋ ਅਤੇ ਤਹਿਸੀਲਦਾਰ ਤੋਂ ਵੀ ਸਲਾਹ ਲੈਂਦੇ ਹਾਂ ਅਤੇ ਅਸੀਂ ਕਾਨਵੀਸ ਤੋਂ ਵੀ ਸਲਾਹ ਲੈਂਦੇ ਹਾਂ